ਮੈਂ ਆਪਣੇ ਸਕੂਲ ਟਾਈਮ ਵਿੱਚ ਯਾਤਰਾ ਗਿਆ ਸੀ ਉਸ ਟਾਈਮ ਸਾਡੇ ਸਕੂਲ ਤੋਂ ਯਾਤਰਾ ਸ੍ਰੀ ਅਨੰਦਪੁਰ ਸਾਹਿਬ ਲਈ ਗਈ ਸੀ ਅਸੀਂ ਉੱਥੇ ਵੱਖ ਵੱਖ ਗੁਰਦੁਆਰੇ ਗੁਰਧਾਮਾਂ ਸਾਰੀ ਜਗ੍ਹਾ ਘੁੰਮੇ ਅਤੇ ਲਾਸਟ ਵਿੱਚ ਅਸੀਂ ਵਿਰਾਸਤ ਏ ਖਾਲਸਾ ਵਿੱਚ ਪਹੁੰਚੇ ਵਿਰਾਸਤ ਏ ਖਾਲਸਾ ਵਿੱਚ ਸਾਡੇ ਗੁਰੂ ਸਾਹਿਬਾਨਾਂ ਦੀਆਂ ਸ਼ਹਾਦਤਾਂ ਵਗੈਰਾ ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ ਜੋ ਕੀਤਾ ਉਨ੍ਹਾਂ ਬਾਰੇ ਉੱਥੇ ਸਭ ਕੁਝ ਦੱਸਿਆ ਗਿਆ ਹੈ